ਹੈਲੋ ਤੁਸੀਂ ਗੋਪਾਲ ਸਵੀਟਸ ਤੋਂ ਬੋਲ ਰਹੇ ਹੋ ਮੈਂ ਇੱਕ ਖਾਣੇ ਲਈ ਓਡਰ ਬੁੱਕ ਕਰਵਾਉਣਾ ਸੀਗਾ ਹਾਂਜੀ ਨੋਟ ਕਰੋ ਇੱਕ ਦਾਲ ਮੱਖਣੀ ਇੱਕ ਸ਼ਾਹੀ ਪਨੀਰ ਚਾਰ ਮਿੱਸੀਆਂ ਰੋਟੀਆਂ ਚਾਰ ਨਾਨ ਅਤੇ ਇੱਕ ਗਰੀਨ ਸੈਲਡ ਜਿਸਦੇ ਨਾਲ ਚਾਰ ਗੁਲਾਬ ਜਾਮੁਣ ਕਰ ਦਿਓ ਪਤਾ ਨੋਟ ਕਰੋ ਜੀ ਇੱਕ ਸੌ ਪੰਜ ਚਨਾਰ ਬਾਗ ਪਟਿਆਲਾ ਅਤੇ ਮੈਂ ਕੈਸ਼ ਓਨ ਡਿਲੀਵਰੀ ਕਰੂੰਗੀ ਜੀ